ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਮਾਨਵ ਪਠਾਨੀਆ ਜਿੱਦਾਂ ਕਿ ਮੈਨੂੰ ਪੰਜ ਬੰਦਿਆਂ ਦੇ ਨਾਂ ਚੇਤਾ ਹਨ ਜੋ ਮੇਰੇ ਘਰ ਦੇ ਨਾਲ ਰਹਿੰਦੇ ਹਨ ਪਹਿਲਾ ਨਾਮ ਵਿਸ਼ੂ ਜੋ ਕਿ ਇੱਕ ਆਰਕੀਟੈਕਟ ਦਾ ਕੰਮ ਕਰਦੇ ਹਨ ਦੂਜਾ ਨਾਂ ਮੋਹਨ ਜੋ ਕਿ ਇੱਕ ਪ੍ਰਾਈਵੇਟ ਕੰਪਨੀ ਵਿੱਚ ਸੋਫਟਵੇਅਰ ਇੰਜੀਨੀਅਰ ਹਨ ਤੀਜਾ ਨਾਂ ਸਿੰਗਲਾ ਜੀ ਜੋ ਕਿ ਪੰਜਾਬ ਅਧਿਅਕਸ਼ ਹਨ ਚੌਥਾ ਨਾਂ ਪਾਰੂ ਜਿਹਨਾਂ ਦੀ ਇੱਕ ਕਰਿਆਨੇ ਦੀ ਸਟੋਰ ਹੈ ਆਖਰੀ ਨਾਂ ਜੋ ਹੈ ਸੱਤਪਾਲ ਜੋ ਕਿ ਇੱਕ ਸਰਕਾਰੀ ਸਕੂਲ ਵਿੱਚ ਟੀਚਰ ਹਨ ਧੰਨਵਾਦ